ਮੈਂ ਦੋ ਹਜ਼ਾਰ ਉੱਨੀ ਵਿੱਚ ਕਮਿਊਨਿਟੀ ਦਾ ਹਿੱਸਾ ਸੀ ਜਦ ਮੈਂ ਕ੍ਰਿਕਟ ਦਾ ਕੈਂਪ ਇੰਟਰਨੈ ਨੈਸ਼ਨਲ ਕੈਂਪ ਲਾ ਰਿਹਾ ਤਾ ਉਸ ਟਾਈਮ ਮੇਰੇ ਦੂਰ ਦੂਰ ਤੋਂ ਯਾਰ ਦੋਸਤ ਵੀ ਤੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਤਾ ਉਹ ਮੇਰੇ ਕੁਛ ਟਾਈਮ ਬਾਅਦ ਯਾਰ ਦੋਸਤ ਬਣ ਗਏ ਮੇਰੇ ਖੇਡਦੇ ਖੇਡਦੇ ਉੱਥੇ ਕੋਈ ਵੀ ਜਾਤ ਪਾਤ ਦਾ ਕੋਈ ਵੀ ਇੱਦਾਂ ਦਾ ਨਹੀਂ ਤਾ ਕੋਈ ਭੇਦਭਾਵ ਨਹੀਂ ਤਾਂ ਸਭ ਇੱਕੋ ਬਰਾਬਰ ਟਰੀਟ ਕਰਿਆ ਜਾਂਦਾ ਤਾ ਸਾਰਿਆਂ ਨੂੰ ਸਭ ਇੱਕ ਥਾਂ ਖਾਣਾ ਖਾਂਦੇ ਤੇ ਰਹਿੰਦੇ ਤੇ ਨਹਾਂਉਦੇ ਤੇ ਸੌਂਦੇ ਤੇ ਸਭ ਇੱਕ ਜਗ੍ਹਾ ਸਵੇਰੇ ਸਾਨੂੰ ਉਹੀ ਪੰਜ ਵਜੇ ਠਾਲਿਆ ਜਾਂਦਾ ਤਾ ਫਿਰ ਆਪਾਂ ਸਾਨੂੰ ਉਹੀ ਰਨਿੰਗ ਰੁਨਿੰਗ ਕਰਾ ਕੇ ਫਿਟਨੈਸ ਫੁਟਨੈਸ ਸਭ ਕੁਝ ਫਿਜੀਕਲ ਕਰਾਇਆ ਜਾਂਦਾ ਤਾ ਉਹ ਤੋਂ ਬਾਅਦ ਸਾਡੀ ਪ੍ਰੈਕਟਿਸ ਹੁੰਦੀ ਤੀ ਪ੍ਰੈਕਟਿਸ ਕਰਨ ਤੋਂ ਬਾਅਦ ਆਪਾਂ ਸਾਰੇ ਇਕੱਠੇ ਖਾਂਦੇ ਤੇ ਇਕੱਠੇ ਖਾਣ ਤੋਂ ਬਾਅਦ ਆਪਾਂ ਫਿਰ ਜਾਣਾ ਆਪਣੇ ਰੂਮ ਪਰ ਜਾਂਦੇ ਰੈਸਟ ਕਰਦੇ ਤੇ ਉਹ ਤੋਂ ਬਾਅਦ ਫਿਰ ਸ਼ਾਮ ਨੂੰ ਆਪਾਂ ਆਉਣਾ ਹੈ ਸ਼ਾਮ ਨੂੰ ਆਉਣ ਤੋਂ ਬਾਅਦ ਆਪਾਂ ਜੋਗਿੰਗ ਕਰਨਾ ਥੋੜ੍ਹਾ ਜਿਹਾ ਸਟਰੈਚਿੰਗ ਕਰਨਾ ਸਟਰੈਚਿੰਗ ਕਰਨ ਤੋਂ ਬਾਅਦ ਆਪਾਂ ਫਿਰ ਥੋੜ੍ਹੀ ਪ੍ਰੈਕਟਿਸ ਕਰਨੀ ਆ ਉੱਥੇ ਇਹ ਤਾਂ ਕੀ ਸਾਡੇ ਸਾਰੇ ਬੜੇ ਸਾਰੇ ਸਪੋਰਟ ਵਿੱਚ ਤੇ ਸਾਰੇ ਸਾਡੇ ਨਾਲ ਇਹ ਇਹ ਸ ਦੇਖ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਕਿਉਂਕਿ ਅਸੀਂ ਮੈਂ ਪਹਿਲੀ ਵਾਰੀ ਗਿਆ ਤਾ ਕੈਂਪ ਲਾਉਣ ਨੈਸ਼ਨਲ ਦੇ ਵਿੱਚ ਕਈ ਸਾਡੇ ਸੀਨੀਅਰ ਵੀ ਤੇ ਸਾਡੇ ਸਾਡੇ ਨਾਲ ਵਧੀਆ ਟਰੀਟ ਕਰ ਰਹੇ ਤੇ ਸਾਨੂੰ ਆਪਣੇ ਭਰਾਵਾਂ ਨਾਲ ਮੰਗ ਮੰਨਦੇ ਸੀ ਇਹ ਕਬੀਲੇ ਕ ਕਮਿਊਨਿਟੀ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਤਾ ਉਹ ਇਹ ਮੇਰਾ ਅਨੁਭਵ ਬਹੁਤ ਵਧੀਆ ਸੀ ਅਨੁਭਵ ਇਹ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਕੋਈ ਬੰਦੇ ਦੂਰ ਤੋਂ ਆਏ ਤੇ ਕੋਈ ਮਦਰਾਸ ਤੋਂ ਆਇਆ ਤਾ ਕੋਈ ਤਮਿਲਨਾਡੂ ਆਇਆ ਤਾ ਹਿਮਾਚਲ ਤੋਂ ਆਏ ਤੇ ਇਹਨਾ ਸਾਰੇ ਬੰਦੇ ਨੈਸ਼ਨਲ ਕੈਂਪ ਲਾ ਕੇ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਹੁਣ ਉਹ ਬੰਦੇ ਸਾਰੇ ਮੇਰੇ ਟੱਚ ਵਿੱਚ ਏ ਇਹ ਸਾਡੀ ਕਮਿਊਨਿਟੀ ਤੀ